ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਤੁਸੀਂ ਆਪਣਾ ਸਰਬੱਤ ਦਾ ਭਲਾ ਬ ਆਲੇ ਬਲਜੀਤ ਸਿੰਘ ਸਿੱਧੂ ਸਰ ਬੋਲਦੇ ਓ ਹਾਂਜੀ ਹਾਂਜੀ ਵਾਹੁ ਵਾਹਿਗੁਰੂ ਜੀ ਨਾ ਇੱਕ ਬੇਨਤੀ ਸੀ ਮੈਂ ਨਾ ਹੰਢਿਆਏ ਤੋਂ ਬੋਲਦਾ ਹੈਗਾ ਹਾਂ ਹਾਂਜੀ ਹਾਂ ਵਾਹਿਗੁਰੂ ਜੀ ਗੱਲ ਏਦਾਂ ਨਾ ਮੇਰੀ ਨਾ ਜਿਹੜੀ ਉਮਰ ਐਗੀ ਸੱਤਰ ਪਜੱਤਰ ਸਾਲ ਦੇ ਕਰੀਬ ਐਗੀ ਹਾਂਜੀ ਹਾਂਜੀ ਕੰਮ ਕਾਰ ਤਾਂ ਦੇਖੋ ਹੁੰਦਾ ਨੀ ਜੁਆਕਾਂ ਦਾ ਆਪੋ ਆਪਦਾ ਨੀ ਲੋਟ ਆਉਂਦਾ ਜੀ ਹਾਂ ਉਹ ਫੇਰ ਬੁਰਾ ਹਾਲ ਐ ਜੀ ਉਹ ਆਪਦਾ ਪਰਿਵਾਰ ਈ ਨੀ ਸੌਖਾ ਉਨ੍ਹਾਂ ਦਾ ਲੋਟ ਆਉਂਦਾ ਤੇ ਮੈਨੂੰ ਦਵਾਈ ਦੱਪੇ ਦਾ ਬਹੁਤ ਔਖਾ ਹੋਇਆ ਪਿਆ ਅੱਖਾਂ ਦਾ ਪ੍ਰੇਸ਼ਨ ਕਰਾਉਣ ਆਲਾ ਪਿਆ ਗਾ ਉਹ ਬਸ ਮੈਂ ਬੈਠੇ ਨੇ ਖੂਹ ਤੇ ਗੱਲਾਂ ਕਰੀ ਜਾਂਦੇ ਸੀ ਤਾਂ ਓਥੇ ਮੈਨੂੰ ਕਿਸੇ ਨੇ ਨਾ ਥੋਡਾ ਨੰਬਰ ਦਿੱਤਾ ਕਹਿੰਦੇ ਉਹ ਸਰਦਾਰ ਜੀਆਂ ਨਾਲ ਗੱਲ ਕਰੋ ਵੀ ਸ਼ੈਦ ਥੋਡੀ ਮਦਦ ਕਰ ਦੇਣ ਹਾਂਜੀ ਹਾਂਜੀ ਠੀਕ ਐ ਅੱਛਾ ਜੀ ਹਾਂਜੀ ਅੱਛਾ ਜੀ ਠੀਕ ਐ ਠੀਕ ਐ ਹਾਂਜੀ ਅੱਛਾ ਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਅੱਛਾ ਜੀ ਠੀਕ ਐ ਠੀਕ ਐ ਪੁੱਤ ਬਸ ਪੁੱਤ ਮੈਨੂੰ ਤਾਂ ਐਂ ਈ ਐਗਾ ਵੀ ਜੇ ਤੁਸੀਂ ਮੈਨੂੰ ਮਾੜਾ ਮੋਟਾ ਦਵਾਈ ਦੱਪੇ ਦਾ ਦੇਖਲੋਂ ਜਾਂ ਮੇਰੇ ਕੋਈ ਲੈਂਜ ਲੁਨਜ ਦਾ ਬਣਦਾ ਹੋਇਆ ਤਾਂ ਉਹ ਦੇਖਲੋ ਹੈਨਾ ਵੀ ਚੱਲ ਹਾਂਜੀ ਠੀਕ ਐ ਪੁੱਤ

ਨਾ ਨਾ ਪੁੱਤ ਕਾਹਨੂੰ ਪਏ ਆ ਦੀਂਦਾ ਈ ਨੀ ਬੁਰਾ ਹਾਲ ਆ ਹਾਂਜੀ ਨਾ ਨਾ ਨਾ ਨਾ ਨਾ ਨਾ ਨਾ ਪੁੱਤ ਹੋਰ ਕੋਈ ਇਹ ਨਾ ਕੁਛ ਤਾਂ ਧੂੰਆਂ ਜਿਹਾ ਪਰਾਲੀ ਪਰੁਲੀ ਦਾ ਅੱਗ ਬਸ ਕੁਛ ਠੰਡਾ ਤੱਤਾ ਪਾਣੀ ਆ ਉਹ ਹਾਂ ਉਹ ਨੀ ਬਸ ਜੀ ਉਮਰ ਹੋਈ ਪਈ ਐ ਪੁੱਤ

ਹੂੰ ਹੂੰ ਹੂੰ ਹਾਂਜੀ ਠੀਕ ਐ ਪੁੱਤ ਹਾਂ ਹਾਂ ਹਾਂ ਠੀਕ ਐ ਪੁੱਤ ਮੈਂ ਆ ਕੇ ਜਾਨਾ ਕੱਲ ਨੂੰ ਕਿਸੇ ਨੂੰ ਭਾਲ ਕੇ ਨਾ ਠੀਕ ਐ ਜਿਉਂਦਾ ਰਹਿ ਪੁੱਤ ਜਿਉਂਦਾ ਰਹਿ ਓਕੇ